ਪੰਜ ਜਨਵਰੀ ਦੋ ਹਜ਼ਾਰ ਸਤਾਰਾਂ ਤੀਹ ਅਗਸਤ ਦੋ ਹਜ਼ਾਰ ਪੰਜ ਦੋ ਨਵੰਬਰ ਦੋ ਹਜ਼ਾਰ ਤਿੰਨ ਸਤਾਈ ਜਨਵਰੀ ਉੱਨੀ ਸੌ ਸਤਾਰਾਂ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ